ਪੀੜ੍ਹੀਆਂ ਤੋਂ ਬਹੁਤ ਸਾਰੇ ਪਕਵਾਨ ਬਣਦੇ ਆਏ ਹਨ ਜਿਨ੍ਹਾਂ ਵਿੱਚੋਂ ਸਾਡਾ ਪਰਿਵਾਰਕ ਪਕਵਾਨ ਕੜ੍ਹੀ ਪਕੌੜਾ ਹੈ ਜਿਵੇਂ ਮੇਰੀ ਨਾਨੀ ਨੇ ਮੇਰੀ ਮੰਮੀ ਨੂੰ ਸਿਖਾਇਆ ਮੰਮੀ ਨੇ ਮੈਨੂੰ ਸਿਖਾਇਆ ਅਤੇ ਹੁਣ ਮੇਰੀ ਬੇਟੀ ਨੇ ਮੇਰੇ ਤੋਂ ਸਿੱਖਿਆ ਕੜ੍ਹੀ ਦਾ ਪਕਵਾਨ ਇਸ ਤਰ੍ਹਾਂ ਬਣਦਾ ਹੈ ਜਿਵੇਂ ਸਭ ਤੋਂ ਪਹਿਲਾਂ ਆਪਾਂ ਨੇ ਪਕੌੜੇ ਬਣਾਉਣੇ ਆ ਪਕੌੜਿਆਂ ਲਈ ਆਪਾਂ ਨੂੰ ਆਲੂ ਪਿਆਜ਼ ਕੱਟਣੇ ਪਹਿਲਾਂ ਉਸ ਤੋਂ ਬਾਅਦ ਬੇਸਣ ਵਿੱਚ ਪਾ ਕੇ ਨਮਕ ਮਿਰਚ ਮਸਾਲਾ ਹਲ਼ਦੀ ਪਾ ਚੰਗੀ ਤਰ੍ਹਾਂ ਪਾਕੇ ਮਿਕਸ ਕਰ ਲੈਣਾ ਅਤੇ ਉਸ ਤੋਂ ਵਿੱਚ ਬਾਅਦ ਕੜਾਹੀ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਉਸਨੂੰ ਚੰਗੀ ਤਰ੍ਹਾਂ ਗਰਮ ਕਰਕੇ ਉਸ ਵਿੱਚ ਪਕੌੜੇ ਚੰਗੀ ਤਰ੍ਹਾਂ ਤਲ਼ ਕੇ ਤਲ਼ ਲੈਣੇ ਅਤੇ ਸਾਈਡ 'ਤੇ ਰੱਖ ਦੇਣੇ ਬਣਾ ਕੇ ਸਾਰੇ ਅਤੇ ਉਸ ਤੋਂ ਬਾਅਦ ਆਪਾਂ ਨੇ ਕੜ੍ਹੀ ਬਣਾਉਣੀ ਹੈ ਕੜ੍ਹੀ ਲਈ ਆਪਾਂ ਨੇ ਜਿਵੇਂ ਸਰ੍ਹੋਂ ਦਾ ਤੇਲ ਪਿਆਜ਼ ਜੀਰਾ ਸ ਜਵੈਣ ਜਵੈਣ ਮੇਥੇ ਕੜ੍ਹੀ ਪੱਤਾ ਤੇਜ ਪੱਤਾ ਇਹ ਚਾਹੀਦਾ ਹੈ ਅਤੇ ਹੁਣ ਆਪਾਂ ਕੜ੍ਹੀ ਕਿਵੇਂ ਬਣਾਉਣੀ ਹੋ ਸਭ ਤੋਂ ਪਹਿਲਾਂ ਆਪਾਂ ਨੇ ਬੇਸਣ ਲੈਣਾ ਏ ਬੇਸਣ ਵਿੱਚ ਲੱਸੀ ਮਿਕਸ ਕਰਕੇ ਚੰਗੀ ਤਰ੍ਹਾਂ ਉਸਨੂੰ ਇੱਕ ਸਾਈਡ 'ਤੇ ਰੱਖ ਦੇਣਾ ਹੈ ਅਤੇ ਦੂਸਰੇ ਪਾਸੇ ਆਪਾਂ ਨੇ ਕੜ੍ਹੀ ਦਾ ਤੜਕਾ ਬਣਾ ਲੈਣਾ ਏ ਤੜਕੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਆਪਾਂ ਨੇ ਪਾਉਣਾ ਏ ਜੀਰਾ ਮੇਥੇ ਤੇਜ ਪੱਤਾ ਅਤੇ ਕੜ੍ਹੀ ਪੱਤਾ ਪਾ ਪਾ ਲੈਣਾ ਉਸ ਤੋਂ ਬਾਅਦ ਉਸਦੇ ਵਿੱਚ ਪਿਆਜ਼ ਪਾਉਣੇ ਉਹਨਾਂ ਨੂੰ ਚੰਗੀ ਤਰਾਂ ਫਰਾਈ ਕਰ ਲੈਣਾ ਅਤੇ ਉਸ ਤੋਂ ਬਾਅਦ ਉਸ ਵਿੱਚ ਨਮਕ ਮਿਰਚ ਮਸਾਲਾ ਹਲ਼ਦੀ ਪਾ ਲੈਣਾ ਅਤੇ ਉਸ ਨੂੰ ਚੰਗੀ ਤਰ੍ਹਾਂ ਸੇਕ ਲਗਵਾ ਕੇ ਆਪਾਂ ਨੇ ਕੜ੍ਹੀ ਜੋ ਕੜ੍ਹੀ ਨੂੰ ਉਬਾਲਾ ਆ ਰਿਹਾ ਏ ਉਸਦੇ ਵਿੱਚ ਆਪਾਂ ਨੇ ਜੋ ਤੜਕਾ ਬਣਾਇਆ ਏ ਆਪਾਂ ਨੇ ਕੜ੍ਹੀ ਵਿੱਚ ਪਾ ਦੇਣਾ ਉਸ ਤੋਂ ਬਾਅਦ ਆਪਾਂ ਨੇ ਉਸਨੂੰ ਘੱਟ ਕਰਕੇ ਘੰਟਾ ਡੇਢ ਘੰਟਾ ਚੰਗੀ ਤਰ੍ਹਾਂ ਰਿਝਾਉਣਾ ਏ ਉਸ ਤੋਂ ਬਾਅਦ ਚੰਗੀ ਤਰ੍ਹਾਂ ਰਿਝਾਅ ਕੇ ਉਹਦੇ ਵਿੱਚ ਆਪਾਂ ਨੇ ਪਕੌੜੇ ਪਾ ਦੇਣੇ ਹੈ ਪਕੌੜੇ ਨਾਲ਼ ਹੀ ਆਪਾਂ ਨੇ ਥੋੜ੍ਹੀ ਮੇਥੀ ਪਾ ਦੇਣੀ ਹੈ ਅਤੇ ਉਸ ਤੋਂ ਬਾਅਦ ਆਪਣੀ ਕੜ੍ਹੀ ਤਿਆਰ ਹੋ ਗਈ